ਹੈਲੋ ਹਾਂਜੀ ਮੈਂ ਊਬਰ ਤੋਂ ਕੈਬ ਬੁੱਕ ਕੀਤੀ ਸੀ ਕੱਲ੍ਹ ਵਾਸਤੇ ਅਤੇ ਮੈਂ ਏਅਰਪੋਰਟ ਜਾਣਾ ਅਤੇ ਮੇਰੀ ਫਲਾਈਟ ਦਾ ਟਾਈਮ ਦਸ ਵਜੇ ਹੈ ਅਤੇ ਮੈਂ ਛੇਤੀ ਪਹੁੰਚਣਾ ਹੈ ਅਤੇ ਮੈਂ ਅੱਠ ਵਜੇ ਤੱਕ ਐਟਲੀਸਟ ਏਅਰਪੋਰਟ 'ਤੇ ਪਹੁੰਚਣਾ ਅਤੇ ਮੇਰਾ ਜਿਹੜਾ ਘਰ ਹੈ ਉਹ ਹੈਗਾ ਏ ਪੰਦਰ੍ਹਾਂ ਵੀਹ ਮਿੰਟ ਦੂਰ ਹੈ ਏਅਰਪੋਰਟ ਤੋਂ ਤਾਂ ਜੇ ਹੋ ਸਕੇ ਤਾਂ ਤੁਸੀਂ ਸਾਢੇ ਸੱਤ ਵਜੇ ਤੱਕ ਪਹੁੰਚ ਜਿਉ ਟਾਈਮ ਨਾਲ ਕਿਉਂਕਿ ਮੈਂ ਆਪਣੀ ਫਲਾਈਟ ਮਿਸ ਨਹੀਂ ਕਰ ਸਕਦੀ ਮੇਰੇ ਵਾਸਤੇ ਬਹੁਤ ਇੰਪੋਰਟੈਂਟ ਹੈ ਅਤੇ ਉਸ ਤੋਂ ਬਾਅਦ ਫਿਰ ਦੋ ਘੰਟੇ ਵਾਸਤੇ ਕੋਈ ਫਲਾਈਟ ਨਹੀਂ ਹੈਗੀ ਤਾਂ ਪਲੀਜ਼ ਤੁਸੀਂ ਕੱਲ੍ਹ ਸਾਢੇ ਸੱਤ ਵਜੇ ਜਿਹੜਾ ਤੁਹਾਨੂੰ ਐਡਰੈਸ ਭੇਜਿਆ ਹੋਇਆ ਘਰ ਦਾ ਉਸ 'ਤੇ ਆ ਜਿਓ